ਅਸੀਂ ਮੋਬਾਇਲ ਤੇ ਜੀ ਪੰਜਾਬੀ ਤੇ ਪੰਜਾਬ ਡੇਲੀ ਪੋਸਟ ਤੇ ਐ ਆਦਿ ਦੇ ਚੈਨਲ ਵੇਖਦੇ ਹਾਂ ਇਸ ਵਿੱਚ ਸਾਨੂੰ ਨਿਊਜ਼ ਬਾਰੇ ਵੀ ਜੋ ਨਿਊਜ਼ ਹੁੰਦੀਆਂ ਸਭ ਕੁਝ ਦਾ ਪਤਾ ਲੱਗਦਾ ਹੈ ਕੀ ਸਾਡੇ ਸਮਾਜ ਵਿੱਚ ਕੀ ਕੁਛ ਹੋ ਰਿਹਾ ਤੇ ਸਾਨੂੰ ਸਾਰਾ ਨਿਊਜ਼ ਵਿੱਚ ਪਤਾ ਲੱਗਦਾ ਹੈ ਅਸੀਂ ਆਜ ਤੱਕ ਨਿਊਜ਼ ਫੀਲ ਡੇਲੀ ਪੋਸਟ ਆਦਿ ਦੇਖਦੇ ਹਾਂ ਜਿਸ ਵਿੱਚ ਸਾਨੂੰ ਸਮਾਜ ਦੇ ਬਾਰੇ ਦੱਸਿਆ ਜਾਂਦਾ ਹੈ ਤੇ ਅੱਜ ਕੱਲ ਦੀ ਜੰਨਰੇਸ਼ਨ ਕਿੰਨੀ ਹੀ ਜਿਆਦਾ ਚੇਂਜ ਹੋ ਰਹੀ ਹੈ ਤੇ ਅੱਜ ਕੱਲ ਕੀ ਕੁਝ ਹੋ ਰਿਹਾ ਸਾਡੇ ਸਮਾਜ ਵਿੱਚ ਜੋ ਕੁਝ ਦੇਖਦੇ ਹਾਂ ਉਸ ਬਾਰੇ ਅਸੀਂ ਕਲਪਨਾ ਕਰਦੇ ਹਾਂ ਕੀ ਅੱਜ ਤੱਕ ਜੋ ਸਾਡੇ ਸਮਾਜ ਵਿੱਚ ਹੋ ਰਿਹਾ ਬਹੁਤ ਕੁਝ ਗਲਤ ਵੀ ਹੋ ਰਿਹਾ ਹੈ ਕਿਤੇ ਪਾਣੀ ਵਗੈਰਾ ਡੁਲਿਆ ਕਿਤੇ ਸਮਾਜ ਦੇ ਨਾਲ ਹੋ ਰਿਹਾ ਤੇ ਕਿਤੇ ਕੁੜੀਆਂ ਨਾਲ ਬਹੁਤ ਕੁਝ ਗਲਤ ਹੋ ਰਿਹਾ ਹੈ ਸਾਨੂੰ ਇਸ ਤਰ੍ਹਾਂ ਦੀਆਂ ਚੀਜਾਂ ਬਾਰੇ ਪਤਾ ਲੱਗਦਾ ਹੈ ਨਿਊਜ਼ ਵਿੱਚ ਤੇ ਕਿਸ ਕਈ ਵਾਰ ਸਾਨੂੰ ਹੋਰ ਕੁਝ ਨਿਊਜ਼ ਵਿੱਚ ਪਤਾ ਲੱਗਦਾ ਹੈ ਜਿਸ ਕਾਰਨ ਅਸੀਂ ਆਪਣੇ ਬੱਚਿਆਂ ਨੂੰ ਸਮਝਾਦੇ ਹਾਂ ਕਿ ਤੁਸੀਂ ਇਦਾਂ ਬਾਹਰ ਵਗੈਰਾ ਕੱਲਿਆਂ ਨੇ ਨਹੀਂ ਜਾਣਾ ਅੱਜ ਕੱਲ ਬਹੁਤ ਕੁਛ ਹੋ ਰਿਹਾ ਇਸ ਕਰਕੇ ਸਾਨੂੰ ਨਿਊਜ਼ ਵਿੱਚ ਬਹੁਤ ਕੁਝ ਪਤਾ ਲੱਗਦਾ ਹੈ ਡੇਲੀ ਪੋਸਟ ਬੈਸਟ ਚੈਨਲ ਹੈਗਾ ਵਾ